ਜਦੋਂ ਵੀ ਮੈਨੂੰ ਕਿਧਰੇ ਗਾਉਣ ਦਾ ਮੌਕਾ ਮਿਲਦਾ ਹੈ ਖਾਸ ਕਰਕੇ ਉਸ ਵੇਲੇ ਜਦੋਂ ਵੱਖ ਵੱਖ ਭਸ਼ਾਵਾਂ ਜਾਂ ਵੱਖ ਵੱਖ ਲੋਕ ਸ਼ੈਲੀਆਂ ਨਾਲ ਗਾਉਣ ਦਾ ਸਾਹਮਣਾ ਹੁੰਦਾ ਹੈ ਮੈਂ ਉਸ ਭਾਸ਼ਾ ਅਤੇ ਸ਼ੈਲੀ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹਾਂ ਜੇ ਮੈਂ ਗਾ ਰਹੀ ਹੁੰਦੀ ਹਾਂ ਅਤੇ ਭਾਸ਼ਾ ਅਤੇ ਸ਼ੈਲੀ ਵਿੱਚ ਇੱਕ ਤਰੀਕਾ ਅਤੇ ਸੁਰੀਲੀ ਅੰਦਾਜ਼ ਹੁੰਦਾ ਹੈ ਜੇ ਜੋ ਕਿ ਸਮਝਣਾ ਅਤੇ ਦੂਸਰੇ ਨੂੰ ਸਮਝ ਆਉਣਾ ਜ਼ਰੂਰੀ ਹੈ ਮੈਂ ਉਸ ਤਾਲੀਆਂ ਅਤੇ ਹਵਾਵਾਂ ਨੂੰ ਧਿਆਨ ਰੱਖਦੇ ਹੋਏ ਸੰਗੀਤਿਕ ਸ਼ੈਲੀ ਦੀ ਯੋਗ ਹੁੰਦੀ ਹਨ ਹਰ ਭਾਸ਼ਾ ਅਤੇ ਸ਼ੈਲੀ ਵਿੱਚ ਆਪਣਾ ਇੱਕ ਖਾਸ ਹਿੱਸਾ ਅਤੇ ਖਾਸ ਸ਼ੈਲੀ ਹੁੰਦੀ ਹੈ ਜਿਸ ਲਈ ਅਸੀਂ ਹਰ ਭਾਸ਼ਾ ਅਤੇ ਸ਼ੈਲੀ ਨੂੰ ਸਮਝ ਕੇ ਲੋਕ ਸ਼ੈਲੀਆਂ ਨਾਲ ਗਾਉਣ ਦਾ ਸਾਹਮਣਾ ਹੁੰਦਾ ਹੈ ਸੰਗਤਿਕ ਸ਼ੈਲੀ ਲਈ ਯੋਗ ਹੁੰਦੀ ਹੈ ਅਤੇ ਉਸਦੀ ਮਦਦ ਨਾਲ ਆਪਣੇ ਪ੍ਰਦਰਸ਼ਨ ਨਾਲ ਸੁੰਦਰ ਬਣਾ ਲੈਂਦੀ ਹੈ ਅਸੀਂ ਹਰ ਭਾਸ਼ਾ ਦੇ ਵਿੱਚ ਉਸ ਨੂੰ ਪੂਰਾ ਧਿਆਨ ਰੱਖਦੇ ਹੋਏ

ਧਿਆਨ ਰੱਖਦੇ ਹਾਂ ਤਾਂ ਕਿ ਹਰ ਸ਼ੈਲੀ ਵਿੱਚ ਇਸਨੂੰ ਚੰਗੇ ਸਲੀਕੇ ਨਾਲ ਗਾਇਆ ਜਾ ਸਕੇ ਅਤੇ ਅਸੀਂ ਇਸਦੇ ਗਾਉਣ ਦੇ ਤਰੀਕੇ ਨੂੰ ਚੰਗੀ ਤਰ੍ਹਾਂ ਸੰਭਾਲ ਸਕੀਏ